ਆਧੁਨਿਕ ਸੰਸਾਰ ਵਿੱਚ ਪੰਜਾਬੀ ਭਾਸ਼ਾ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਅੱਜ ਕੱਲ੍ਹ ਜ਼ਿਆਦਾ ਇੰਗਲਿਸ਼ ਦਾ ਕਲਚਰ ਹੋਣ ਕਾਰਨ ਉਹ ਸਕੂਲਾਂ ਦੇ ਵਿੱਚ ਵੀ ਜ਼ਿਆਦਾ ਇੰਗਲਿਸ਼ 'ਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਮਾਪੇ ਵੀ ਆਪਣੇ ਬੱਚਿਆਂ ਨੂੰ ਇਹ ਸੋਚ ਸੋਚ ਕੇ ਆਹ ਕਰ ਦਿੰਦੇ ਜੋ ਕਿ ਕੁੱਤੇ ਨੂੰ ਕੁੱਤਾ ਨਹੀਂ ਕਹਿਣਾ ਡੌਗੀ ਕਹੋ ਡੈਡ ਕਹੋ ਮੋਮ ਕਹੋ ਅਤੇ ਇਸਦਾ ਤਾਂ ਉਸ ਵਿੱਚ ਆਪਣਾ ਫਕਰ ਮਹਿਸੂਸ ਕਰ ਕਰ ਰਹੇ ਨੇ ਵੀ ਜੋ ਅਸੀਂ ਸਾਡਾ ਬੱਚਾ ਜੇ ਪੰਜਾਬੀ ਬੋਲੂਗਾ ਤਾਂ ਇਹ ਗਵਾ ਆਪਣੇ ਗਵਾਰ ਹੀ ਸਮਝਿਆ ਜਾਵੇਗਾ ਸਕੂਲਾਂ ਵਾਲੇ ਵੀ ਇਸ ਤੋਂ ਘੱਟ ਨਹੀਂ ਹੈਗੇ ਇੱਕ ਪੰਜਾਬ ਵਿੱਚ ਸਕੂਲ ਹੁੰਦੇ ਹੋਏ ਵੀ ਬਹੁਤੇ ਸਕੂਲਾਂ 'ਚ ਪੰਜਾਬੀ ਦੀ ਪੁਸਤਕ ਹੀ ਅਲੋਡ ਨਹੀਂ ਹੈਗੀ ਵੀ ਉਹ ਬੱਚੇ ਪੰਜਾਬੀ ਪੜ੍ਹ ਲੈਣ ਜਾਂ ਪੰਜਾਬੀ ਬੋਲ ਲੈਣ ਬਹੁਤ ਸਕੂਲਾਂ 'ਚ ਤਾਂ ਅਜਿਹੀ ਵੀ ਸਮੱਸਿਆ ਆ ਰਹੀ ਹੈ ਕਿ ਬੱਚੇ ਜੇ ਪੰਜਾਬੀ ਬੋਲਦੇ ਆ ਤਾਂ ਪੰਜਾਬੀ ਬੋਲਦੇ ਆ ਤਾਂ ਉਸ ਨੂੰ ਜੁਰਮਾਨਾ ਵੀ ਦਿੱਤਾ ਜਾਂਦਾ ਲਾਇਆ ਜਾਂਦਾ ਉਹ ਤੇ ਨੂੰ ਦੰਡ ਵੀ ਦਿੱਤਾ ਜਾਂਦਾ ਪਰ ਇਸ ਦੇ ਬਾਵਜੂਦ ਵੀ ਪੰਜਾਬੀ ਇੱਕ ਆਪਣਾ ਸਭ ਨੂੰ ਸ ਉੱਤਮ ਸਥਾਨ ਰੱਖਦੀ ਹੈ ਇਸ ਤੋਂ ਹੋਰ ਵੀ ਆਧੁਨਿਕ ਸੰਸਾਰ ਵਿੱਚ ਜੋ ਸਭ ਨੂੰ ਵੱਡਾ ਵਪਾਰ 'ਚ ਪੈ ਰਿਹਾ ਵਪਾਰ 'ਚ ਪੰਜਾਬੀ ਨੂੰ ਬਾਹਰਲੇ ਦੇਸ਼ਾਂ 'ਚ ਕਰਦੇ ਆ ਉੱਥੇ ਇੰਗਲਿਸ਼ ਦਾ ਬੋਲ ਬਾਲਾ ਹੀ ਰਹਿੰਦਾ ਹੈਗਾ ਉਸ ਨਾਲ ਵੀ ਉਸ ਮਜਬੂਰੀਆਂ ਹੈਗੀਆ ਵੀ ਇੰਗਲਿਸ਼ ਸਿੱਖਣੀ ਬੱਚਿਆਂ ਦੀ ਮਜ਼ਬੂਰੀ ਹੈ ਉਹ ਬਾਹਰਲੇ ਦੇਸ਼ 'ਚ ਜਾ ਕੇ ਉਹਨਾਂ ਨੇ ਆਪਣਾ ਉਹਨਾਂ ਦੀ ਭਾਸ਼ਾ ਨਾਲ ਭਾਸ਼ਾ 'ਚ ਗੱਲ ਕਰਨੀ ਚੀਨੀਆਂ ਨਾਲ ਚੀਨੀਆਂ ਦੀ ਭਾਸ਼ਾ 'ਚ ਗੱਲ ਕਰਨੀ ਹਿੰਦੀ ਅਤੇ ਹਿੰਦੀ 'ਚ ਭਾਸ਼ਾ 'ਚ ਗੱਲ ਕਰਨੀ ਅਤੇ ਪੰਜਾਬੀ ਨੂੰ ਚਾਰ ਸਪੇਰੋਂ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰ ਪੈ ਕਰਨਾ ਪੈ ਰਿਹਾ ਹੈ ਅਤੇ ਅਖਬਾਰਾਂ ਦੀ ਅਖਬਾਰ ਦਾ ਪ੍ਰਚਲਿਕ ਘਟਨਾ ਕਾਰਨ ਵੀ ਜੋ ਅਖਬਾਰ ਪੰਜਾਬੀ ਦੇ ਪੜ੍ਹੇ ਜਾਂਦੇ ਸੀ ਅੱਜ ਬਹੁਤ ਉਹਨਾਂ ਦੀ ਗਿਣਤੀ ਘੱਟ ਰਹਿ ਗਈ ਹੈ ਅਤੇ ਕੁਛ ਫਿਰ ਵੀ ਜਿਵੇਂ ਸੱਭਿਆਚਾਰਕ ਮੇਲੇ ਹੁੰਦੇ ਨੇ ਪੰਜਾਬੀ 'ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਉਸ ਬੁੱਧੀਜੀਵੀ ਇਸ ਨੂੰ ਪੰਜਾਬੀ ਨੂੰ ਅਜੇ ਸੰਭਾਲੇ ਸੰਭਾਲੇ ਬੈਠੇ ਨੇ ਅਤੇ ਆਪੋ ਫਿਰ ਵੀ ਪੰਜਾਬੀ ਕੁਸ ਕਿਸੇ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਆਪਣਾ ਸਰਬ ਸਤਾਨ ਆਪਣਾ ਮਹਿਸੂਸ ਰ ਮਹਿਫੂਜ਼ ਰੱਖੇਗੀ ਅਤੇ ਵਕਤ ਬੱਚਿਆਂ ਦੇ ਵਿੱਚ ਵੀ ਜੋ ਬਾਹਰਲੇ ਜਾਂਦੇ ਆ ਆਈਲੈਟਸ ਮੈਂ ਖੁੱਲ੍ਹ ਗਏ ਹੋਰ ਵੀ ਉਹਨਾਂ ਕਾਰਨ ਵੀ ਬਹੁਤ ਉਹ ਪੰਜਾਬੀ ਅਤੇ ਨੂੰ ਸਾਹਮਣਾ ਕਰਨਾ ਪੈ ਪੈਂਦਾ ਹੈਗਾ ਏ ਅੱਜ ਕੱਲ੍ਹ ਅਤੇ ਬ ਜੋ ਜੋ ਵੀ ਕਿਤੇ ਮੇਲੇ ਹੁੰਦੇ ਆ ਉਸ ਵਿੱਚ ਵੀ ਵਰਡ ਜ਼ਿਆਦਾ ਪੰਜਾਬੀ ਦੇ ਵ ਪੰਜਾਬੀ ਦੇ ਵਿੱਚ ਇੰਗਲਿਸ਼ ਦੇ ਵੜ ਗਏ ਜੋ ਵੀ ਇੱਕ ਬਹੁਤ ਮਾੜਾ ਇਸ ਨੂੰ ਆਪਣਾ ਚੁਣੌਤੀਆਂ ਦਾ ਬਹੁਤ ਜ਼ਿਆਦਾ ਸਾਹਮਣਾ ਕਰਨਾ ਪੈ ਰਿਹਾ